ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰੁਣ ਕੁਮਾਰ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਹਿੰਦਾ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਗਰੀਬੀ ਅਤੇ ਬੇਰੁਜ਼ਗਾਰ ਦੀ ਸਥਿਤੀ ਕਿਹੋ ਜਿਹੀ ਹੈ ਪੰਜਾਬ ਵਿੱਚ ਗਰੀਬੀ ਅਤੇ ਬੇਰੁਜ਼ਗਾਰ ਦੀ ਸਥਿਤੀ ਵੱਖ ਵੱਖ ਸਮੇਂ 'ਤੇ ਬਦਲਦੀ ਆ ਰਹੀ ਹੈ ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਕੁਝ ਸੁਧਾਰ ਆਇਆ ਹੈ ਪਰ ਹਾਲੇ ਵੀ ਇਹ ਮਹੱਤਵਪੂਰਨ ਮਸਲਾ ਬਣਿਆ ਹੋਇਆ ਕਈ ਸਮਾਜਿਕ ਅਤੇ ਆਰਥਿਕ ਕਾਰਨ ਹਨ ਜਿਵੇਂ ਕਿ ਸਿੱਖਿਆ ਦੀ ਘਾਟ ਕੰਮ ਦੀ ਘੱਟ ਮੌਜੂਦਗੀ ਅਤੇ ਮਹਿਲਾਵਾਂ ਦੀ ਘੱਟ ਹਿੱਸੇਦਾਰੀ ਪੰਜਾਬ ਸਰਕਾਰ ਵੱਲੋਂ ਗਰੀਬੀ ਘਟਾਉਣ ਅਤੇ ਨੌਕਰੀ ਵਧਾਉਣ ਲਈ ਕਈ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਿ ਸਰਕਾਰੀ ਉਪਰਾਲੇ ਜੋ ਕੀਤੇ ਜਾ ਰਹੇ ਹਨ ਇਹਨਾਂ ਵਿੱਚ ਸਵੈ ਰੋਜ਼ਗਾਰ ਯੋਜਨਾਵਾਂ ਆਉਂਦੀਆਂ ਹਨ ਇਹਨਾਂ ਯੋਜਨਾਵਾਂ ਦੇ ਵਿੱਚ ਇੱਕ ਯੋਜਨਾ ਹੈ ਮੁਦਰਾ ਯੋਜਨਾ ਇਹ ਯੋਜਨਾ ਵਿੱਚ ਮੱਧਮ ਦਰਜੇ ਦੇ ਉਦਮੀਆਂ ਨੂੰ ਸਹਾਇਤਾ ਦੇਣ ਲਈ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਨਾਲ ਸਵੈ ਰੁਜ਼ਗਾਰ ਦੇ ਮੌਕੇ ਮਿਲ ਸਕਦੇ ਹਨ ਸਰਕਾਰ ਵੱਲੋਂ ਸ਼ੁਰੂਆਤੀਆਂ ਨੂੰ ਭਰੋਸਾ ਹਨ ਅਤੇ ਮਾਲੀ ਸਹਾਇਤਾ ਮੁਹੱਈਆ ਕਰਾ ਕਰਵਾਈ ਜਾਂਦੀ ਹੈ ਹੋਰ ਸਰਕਾਰ ਵੱਲੋਂ ਕੌਂਸਲ ਵਿਕਾਸ ਕੈਂਪਸ ਵੀ ਲਾਏ ਜਾਂਦੇ ਹਨ ਜਿਹਨਾਂ ਦੇ ਵਿੱਚ ਕੌਂਸਲ ਵਿਕਾਸ ਅਤੇ ਯੂਵਾ ਨੂੰ ਮਾਰਕੀਟ ਦੀਆਂ ਲੋੜਾਂ ਮੁਤਾਬਿਕ ਪਰਸ਼ਿਕਸ਼ਤ ਕਰਨ ਲਈ ਕੈਂਪਸ ਖੋਲ੍ਹੇ ਜਾਂਦੇ ਹਨ ਤਕਨੀਕੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਨੌਜਵਾਨਾਂ ਨੂੰ ਤਾਂ ਕਿ ਉਹਨਾਂ ਨੂੰ ਵਧੇਰੀ ਤਕਨੀਕੀ ਨੌਕਰੀਆਂ ਲਈ ਯੋਗ ਬਣਾਇਆ ਜਾ ਸਕੇ ਇਹ ਸਾਡੇ ਉਪਰਾਲੇ ਪੰਜਾਬ ਵਿੱਚ ਗਰੀਬੀ ਘਟਾਉਣ ਅਤੇ ਨੌਕਰੀਆਂ ਵਧਾਉਣ ਵੱਲ ਕਦਮ ਹਨ ਇਸ ਦੇ ਨਾਲ ਹੀ ਸਥਾਨਕ ਅਤੇ ਰਾਜਸਥਰੀ ਸੰਸਥਾਵਾਂ ਵੀ ਇਸ ਮਾਮਲੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ ਧੰਨਵਾਦ